ਕੈਮੀਕਲ ਦਵਾਈਆਂ ਦੇ ਨਾਲ ਨਾਲ ਹੋਮੋਪੈਥਿਕ ਦਵਾਈਆਂ ਦੀ ਵਰਤੋਂ ਬਹੁਤ ਵੱਧ ਗਈ ਹੈ ਕਈ ਸਮਝਦਾਰ ਲੋਕ ਹੋਮੋ ਜ਼ਿਆਦਾਤਰ ਹੋਮੋਪੈਥਿਕ ਦਵਾਈਆਂ ਦੀ ਹੀ ਵਰਤੋਂ ਕਰਦੇ ਹਨ ਇਹ ਨੈਚੁਰਲ ਤਰੀਕੇ ਨਾਲ ਬਣਾਈਆਂ ਜਾਂਦੀਆਂ ਹਨ ਜਿਵੇਂ ਕਿ ਜੜ੍ਹੀਆਂ ਬੂਟੀਆਂ ਅਤੇ ਪਹਾੜਾਂ ਵਿੱਚੋਂ ਕਈ ਬੂਟੀਆਂ ਆਦਿ ਅ ਮੰਗਵਾਈਆਂ ਜਾਂਦੀਆਂ ਹਨ ਉਹਨ ਉਹਨਾਂ ਜਿਹੜੀਆਂ ਬੂਟੀਆਂ ਨਾਲ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ ਹੋਮੋਪੈਥਿਕ ਦਵਾਈਆਂ ਹੌਲੀ ਹੌਲੀ ਅਸਰ ਕਰਦੀਆਂ ਹਨ ਹੋਮੋਪੈਥਿਕ ਜਿਹੜੀ ਦਵਾਈਆਂ ਹੁੰਦੀਆਂ ਇਹ ਹੌਲੀ ਹੌਲੀ ਅਸਰ ਕਰਦੀਆਂ ਹਨ ਇਹ ਕੁਦਰਤੀ ਤਰੀਕੇ ਨਾਲ ਬਣੀਆਂ ਹੁੰਦੀਆਂ ਹਨ ਜਿਵੇਂ ਕਿ ਜੜੀਆਂ ਬੂਟੀਆਂ ਨੂੰ ਤਿਆਰ ਤਿਆਰ ਕ ਤਿਆਰ ਕਰਨ ਦੇ ਵਿੱਚ ਬਹੁਤ ਸਮਾਂ ਲੱਗਦਾ ਹੈ ਇਸ ਤਰ੍ਹਾਂ ਹੀ ਇਸ ਇਸ ਨਾਲ ਹੀ ਇਹ ਮਹਿੰਗੀਆਂ ਆਉਂਦੀਆਂ ਹਨ ਹਸਪਤਾਲ ਇਸ ਕਰਕੇ ਇਹ ਮਹਿੰਗੀਆਂ ਆਉਂਦੀਆਂ ਹਨ ਅਤੇ ਜੋ ਇਹਨਾਂ ਦਾ ਅਸਰ ਹੈ ਇਹ ਹੌਲੀ ਹੌਲੀ ਅਸਰ ਆਪਣਾ ਅਸਰ ਦਿਖਾਉਂਦੀਆਂ ਹਨ ਹਸਪਤਾਲਾਂ ਵਿੱਚ ਮਿਲਣ ਵਾਲੀਆਂ ਦਵਾਈਆਂ ਨੂੰ ਜ ਦਵਾਈਆਂ ਜਲਦੀ ਠੀਕ ਕਰ ਦਿੰਦੀਆਂ ਹਨ ਪਰ ਇਹ ਸਾਡੀ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ ਹੋਮੋਪੈਥਿਕ ਦਵਾਈਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਇਹ ਇਹ ਦੂਸਰੀ ਮੈਡੀਕਲ ਜਾਂ ਕੈਮੀਕਲ ਨਾਲ ਬਣੀਆਂ ਹੋਈਆਂ ਦਵਾਈਆਂ ਤੋਂ ਵਧੀਆਂ ਹੁੰਦਾ ਹੈ ਇਸ ਲਈ ਅਸੀਂ ਵੀ ਹੋਮੋਪੈਥਿਕ ਪ੍ਰੋਸੈਸ ਹੀ ਯੂਜ਼ ਕਰਦੇ ਹਾਂ